ਸਤਿ ਸ਼੍ਰੀ ਅਕਾਲ ਜੀ ਮੈਂ ਸਲੋਨੀ ਹਾਂ ਅੇਅ ਮੈਂ ਪਿਛਲੇ ਹਫ਼ਤੇ ਹੀ ਤੁਹਾਡੀ ਸ਼ੋਪ ਤੋਂ ਇੱਕ ਲੈਪਟੋਪ ਖਰੀਦਿਆ ਸੀ ਅਤੇ ਉਹ ਬਹੁਤ ਹੀ ਵਧੀਆ ਹੈ ਜਿਵੇਂ ਦਾ ਤੁਸੀਂ ਦੱਸਿਆ ਸੀ ਉਵੇਂ ਦਾ ਹੀ ਆਇਆ ਹੈ ਇਹ ਤੁਸੀਂ ਤਾਂ ਕਿਹਾ ਸੀ ਕਿ ਇਹ ਇੱਕ ਹਫ਼ਤੇ ਵਿੱਚ ਹੀ ਡਿਲੀਵਰ ਹੋਊਗਾ ਇਹ ਤਾਂ ਮੇਰੇ ਕੋਲ ਚਾਰ ਦਿਨਾਂ ਵਿੱਚ ਹੀ ਆ ਗਿਆ ਹੈ ਅਤੇ ਮੈਂ ਮੈਂ ਇੱਕ ਟੀਚਰ ਹਾਂ ਅਤੇ ਮੇਰੀ ਸਾਰਾ ਹੀ ਕੰਮ ਇਸ 'ਤੇ ਹੁੰਦਾ ਹੈ ਅਤੇ ਇਸ ਵਿੱਚ ਮੇਰੀ ਸਾਰੀਆਂ ਫਾਈਲਾਂ ਸਾਰੇ ਡੋਕੂਮੈਂਟਸ ਸਾਰੇ ਇਸ 'ਚ ਹੀ ਹਨ ਇਹ ਬਿਲਕੁਲ ਵੀ ਹੈਂਗ ਨਹੀਂ ਹੋਇਆ ਅਤੇ ਇਸਦਾ ਸੋਫਟਵੇਅਰ ਇਸਦੇ ਜਿਹੜਾ ਐਂਟੀ ਵਰਜ਼ਨ ਹੈ ਇਹ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਅਤੇ ਇਸਦਾ ਚਾਰਜਰ ਵੀ ਬਹੁਤ ਵਧੀਆ ਹੈ ਅਤੇ ਤੁਸੀਂ ਜਿਹੜਾ ਇਸ 'ਚ ਦਸ ਪਰਸੈਂਟ ਔਫ਼ ਦਿੱਤਾ ਸੀ ਉਹ ਮੇਰੀਆਂ ਸਹੇਲੀਆਂ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਉਹ ਸਾਰੇ ਹੀ ਹੁਣ ਇਸ 'ਤੇ ਇਸਨੂੰ ਖਰੀਦਣਾ ਚਾਹੁੰਦੇ ਹਨ ਅਤੇ ਮੈਂ ਵੀ ਇਹੀ ਮੈਂ ਵੀ ਇਸ ਲੈਪਟੋਪ ਨੂੰ ਲੈ ਕੇ ਬਹੁਤ ਹੀ ਜਿਆਦਾ ਖੁਸ਼ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਵੀ ਸਾਰੇ ਇਸ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋਣ ਅਤੇ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਹੈ ਕਿ ਤੁ ਤੁਹਾਡੀ ਹੀ ਸ਼ੋਪ ਤੋਂ ਇਹ ਖਰੀਦ ਖਰੀਦਣ ਅਤੇ ਤੁਹਾਡੀ ਸ਼ੋਪ ਤੋਂ ਜਿਵੇਂ ਕਿ ਲੈਪਟੋਪਸ ਔਰ ਘੜੀਆਂ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਮਿਲਦਾ ਹੈ ਅਤੇ ਬਹੁਤ ਹੀ ਵਧੀਆ ਹੁੰਦਾ ਹੈ ਬਹੁਤ ਧੰਨਵਾਦ ਤੁਹਾਡਾ